ਇੱਕ ਵਾਰ ਦੀ ਗੱਲ ਹੈ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਰੋਪੜ ਆਈ ਆਈ ਟੀ ਵਿੱਚ ਜੋਬ ਕਰਦਾ ਹਾਂ ਇਤ ਇਸ ਕਿੱਤੇ ਵਿੱਚ ਬਹੁਤ ਜ਼ਿਆਦਾਤਰ ਸਟਾਫ਼ ਬਾਹਰਲੇ ਸਟੇਟ ਤੋਂ ਹੈ ਅਤੇ ਉਸ ਕਾਰਨ ਉਹਨਾਂ ਨੂੰ ਪੰਜਾਬੀ ਲਿਖਣ ਪੜ੍ਹਨ ਸੁਣਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਪਰ ਮੈਂ ਇੱਕ ਲੋਕਲ ਹੋਣ ਦੇ ਨਾਤੇ ਮੈਨੂੰ ਮਾਣ ਮਹਿਸੂਸ ਹੋਇਆ ਜਦੋਂ ਮੈਂ ਇਹਨਾਂ ਨਾਲ ਗੱਲ ਕਰਦਾ ਹਾਂ ਪੰਜਾਬੀ ਵਿੱਚ ਜਾਂ ਇਹਨਾਂ ਦੀ ਕੋਈ ਮਦਦ ਕਰਦਾ ਪੰਜਾਬੀ ਵਿੱਚ ਇੱਕ ਵਾਰ ਦੀ ਗੱਲ ਹੈ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇੱਕ ਪੁਲਿਸਮੈਨ ਆਉਂਦਾ ਹੈ ਵੈਰੀਫਿਕੇਸ਼ਨ ਕਰਨ ਇੱਕ ਕੰਪਨੀ ਦੀ ਪਰ ਅਫ਼ਸੋਸ ਅੱਗਿਉਂ ਉਹ ਜੋ ਵੀ ਲੜਕਾ ਸੀ ਕੰਪਨੀ ਦਾ ਮਾਲਕ ਉਹ ਪੰਜਾਬੀ ਨਹੀਂ ਸਮਝਦਾ ਸੀ ਉਦੋਂ ਉਸ ਟਾਈਮ ਕੀ ਦ ਦਿੱਕਤ ਆਈ ਕਿ ਪੁਲਿਸਮੈਨ ਨੂੰ ਜੋ ਵੈਰੀਫਿਕੇਸ਼ਨ ਕਰਨੀ ਸੀ ਉਹ ਪੰਜਾਬੀ ਵਿੱਚ ਕਰਨੀ ਸੀ ਕਿਉਂਕਿ ਜੋ ਉਹਦੇ ਕੋਲ ਚਿੱਠੀ ਪੱਤਰ ਸੀ ਪਰਫਾਰਮਾ ਸੀ ਉਹ ਪੰਜਾਬੀ ਵਿੱਚ ਸੀ ਅਤੇ ਉਸਨੇ ਉਸ ਟਾਈਮ ਕੀ ਹੋ ਹੁੰਦਾ ਹੈ ਕਿ ਉਹ ਉਸਨੇ ਮੈਨੂੰ ਬੁਲਾਇਆ ਕਿ ਕਿਰਪਾ ਕਰਕੇ ਤੁਸੀਂ ਮੇਰੀ ਮਦਦ ਕਰੋਗੇ ਤਾਂ ਜੋ ਮੈਂ ਆਪਣੀ ਵੈਰੀਫਿਕੇਸ਼ਨ ਇੱਕ ਸਫਲਤਾ ਪੂਰਵਕ ਕਰ ਸਕਾਂ ਉਸ ਟਾਈਮ 'ਤੇ ਮੈਨੂੰ ਉਸ ਦੀ ਮਦਦ ਕਰਕੇ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਜੋ ਪੰਜਾਬੀ ਮਾਂ ਬੋਲੀ ਹੈ ਇਹ ਵੱਧ ਤੋਂ ਵੱਧ ਪ੍ਰਫੁੱਲਿਤ ਹੋਵੇ ਅਤੇ ਵੱਧ ਤੋਂ ਵੱਧ ਬਾਹਰਲੇ ਲੋਕ ਇਹਨੂੰ ਸਿੱਖ ਸਕਣ